ਸਕੂਲਾਂ ਦੇ ਵਿੱਚ ਪੜ੍ਹਾਉਣ ਵੇਲੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਾਰੇ ਹੀ ਵਿਦਿਆਰਥੀਆਂ ਨੂੰ ਉਹਨਾਂ ਦੀ ਆਪਣੀ ਮਾਂ ਬੋਲੀ ਦੇ ਵਿੱਚ ਹੀ ਪਹਿਲੇ ਤਿੰਨ ਜਾਂ ਚਾਰ ਸਾਲ ਪੜ੍ਹਾਉਣਾ ਚਾਹੀਦਾ ਉਸ ਤੋਂ ਬਾਅਦ ਹੀ ਦੂਜੀਆਂ ਭਾਸ਼ਾਵਾਂ ਸਿਖਾਉਣੀਆਂ ਚਾਹੀਦੀਆਂ ਹਨ ਦੂਸਰਾ ਵੱਧ ਤੋਂ ਵੱਧ ਸਰਕਾਰੀ ਸਕੂਲ ਹੋਣ ਤਾਂ ਜੋ ਹਰ ਇੱਕ ਅਮੀਰ ਅਤੇ ਗਰੀਬ ਦਾ ਬੱਚਾ ਇੱਕ ਹੀ ਸਕੂਲ ਵਿੱਚ ਜਾ ਕੇ ਵਿੱਦਿਆ ਪ੍ਰਾਪਤ ਕਰੇ ਤੀਸਰਾ ਜਿਹੜੇ ਨੌਜਵਾਨ ਬੇਰੁਜ਼ਗਾਰ ਹਨ ਅਤੇ ਨਿਪੁੰਨਤਾ ਰੱਖਦੇ ਹਨ ਉਹਨਾਂ ਨੂੰ ਵੱਧ ਤੋਂ ਵੱਧ ਤਨਖਾਹਾਂ ਦੇ ਕੇ ਸਕੂਲਾਂ ਦੇ ਵਿੱਚ ਭਰਤੀ ਕਰਨਾ ਚਾਹੀਦਾ ਹੈ ਅਤੇ ਥੋੜ੍ਹੇ ਬੱਚਿਆਂ ਦੇ ਮਗਰ ਇੱਕ ਇੱਕ ਅਧਿਆਪਕ ਜ਼ਰੂਰ ਰੱਖਣਾ ਚਾਹੀਦਾ ਹੈ ਵਿਸ਼ੇ ਮਾਹਿਰਾਂ ਦੇ ਅਲੱਗ ਅਲੱਗ ਲਗਾਤਾਰ ਲੈਕਚਰ ਕਰਵਾਉਣੇ ਚਾਹੀਦੇ ਹਨ ਅਤੇ ਵਿਦਿਆਰਥੀਆਂ ਨੂੰ ਪੜ੍ਹਨ ਦੇ ਲਈ ਲਗਾਤਾਰ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ ਵਿਦਿਆਰਥੀਆਂ ਦੀ ਨਿਪੁੰਨਤਾ ਦੇ ਅਨੁਸਾਰ ਅੱਗੇ ਉਹਨਾਂ ਨੂੰ ਰੋਜ਼ਗਾਰ ਅਤੇ ਉਹਨਾਂ ਦੇ ਭਵਿੱਖ ਨੂੰ ਸਵਾਰਨ ਦੇ ਲਈ ਵੱਖ ਵੱਖ ਯੋਜਨਾਵਾਂ ਦਾ ਆਯੋਜਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਵਿੱਦਿਆ ਨੂੰ ਲੈ ਕੇ ਗਿਆਨ ਨੂੰ ਲੈ ਕੇ ਆਪਣੇ ਅੰਦਰ ਇੱਕ ਨਵਾਂ ਉਭਾਰ ਅਤੇ ਜੋਸ਼ ਮਹਿਸੂਸ ਕਰਨ ਅਤੇ ਇਸ ਵਿੱਚ ਵੱਧ ਤੋਂ ਵੱਧ ਰੁਚੀ ਦਿਖਾਉਣ